ਗਾਉਣ ਵਿੱਚ ਮੇਰੀ ਸਭ ਤੋਂ ਪਸੰਦੀਦਾ ਸ਼ੈਲੀ ਸੱਭਿਆਚਾਰਕ ਸ਼ੈਲੀ ਹੈ ਕਿਉਂਕਿ ਇਸ ਵਿੱਚ ਸਾਡੇ ਪਜ ਸੱਭਿਆਚਾਰ ਨੂੰ ਦਰਸਾਇਆ ਜਾਂਦਾ ਹੈ ਅਤੇ ਇਸ ਵਿੱਚ ਸਾਡੇ ਪੰਜਾਬ ਦੇ ਸੱਭਿਆਚਾਰ ਅਤੇ ਉਹਨਾਂ ਬਾਰੇ ਦੱਸਿਆ ਜਾਂਦਾ ਹੈ ਇਸ ਲਈ ਮੇਰੀ ਸਭ ਤੋਂ ਪਸੰਦੀਦਾ ਸ਼ੈਲੀ ਸੱਭਿਆਚਾਰਕ ਸ਼ੈਲੀ ਹੈ ਸੱਭਿਆਚਾਰਕ ਸ਼ੈਲੀ ਵਿੱਚ ਪੰਜਾਬ ਦੇ ਹਰ ਇੱਕ ਹਰ ਇੱਕ ਲੋਕ ਗੀਤ ਭੰਗੜਾ ਗਿੱਧਾ ਲੁੱਡੀ ਇਹਨਾਂ ਨੂੰ ਚੰਗੀ ਤਰ੍ਹਾਂ ਦਰਸਾਇਆ ਜਾਂਦਾ ਹੈ ਇਸ ਲਈ ਇਹ ਮੇਰੀ ਸਭ ਤੋਂ ਪਸੰਦੀਦਾ ਸ਼ੈਲੀ ਹੈ ਸੰਗੀਤ ਦੀ ਸ਼ੈਲੀ ਕੀ ਹੁੰਦੀ ਹੈ ਸੰਗੀਤ ਦੀ ਸ਼ੈਲੀ ਉਹ ਹੁੰਦੀ ਹੈ ਜਿਸ ਵਿੱਚ ਅਸੀਂ ਵੱਖ ਵੱਖ ਕਲਚਰ ਅਤੇ ਉਨ੍ਹਾਂ ਦੇ ਗੀਤਾਂ ਅਤੇ ਉਨ੍ਹਾਂ ਦੇ ਦੇਸ਼ਾਂ ਬਾਰੇ ਵਰਣਨ ਕਰਦੇ ਹਾਂ